ਸਤਿ ਸ਼੍ਰੀ ਅਕਾਲ ਜੀ ਮੇਰੀ ਦਸ ਜੁਲਾਈ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਫਲਾਈਟ ਹੈ ਅਤੇ ਮੈਨੂੰ ਅਨ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਜਾਣ ਲਈ ਉਸ ਵਕਤ ਕੋਈ ਬੱਸ ਉਪਲਬਧ ਨਹੀਂ ਹੈ ਅਤੇ ਕਿਆ ਕਿਰਪਾ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ ਉਸ ਟਾਇਮ ਕੋਈ ਕੈ ਅਪ ਗੱਡੀ ਉਪਲਬਧ ਹੋ ਸਕਦੀ ਹੈ ਅਤੇ ਜੇ ਉਪਲਬਧ ਹੋ ਸਕਦੀ ਹੈ ਤਾਂ ਮੈਨੂੰ ਛੇ ਵਜੇ ਦੇ ਕਰੀਬ ਸੰਪਰਕ ਕਰ ਸਕਦੇ ਹੋ